ਹੈਲੋ ਮੈਮ ਸਤਿ ਸ੍ਰੀ ਅਕਾਲ ਜੀ ਮੈਮ ਪਾਣੀ ਸਪਲਾਈ ਤੋਂ ਬੋਲ ਰਹੇ ਹੋ ਹਾਂਜੀ ਮੈਮ ਸ਼ਿਕਾਇਤ ਕਰਵਾਉਣੀ ਸੀ ਮੈਮ ਸਾਡੇ ਨਾ ਪਾਣੀ ਬਿਲਕੁਲ ਹੀ ਨਹੀਂ ਆ ਰਿਹਾ ਜੀ ਮੈਮ ਕਈ ਦਿਨਾਂ ਤੋਂ ਨੀ ਆ ਰਿਹਾ ਤੁਹਾਨੂੰ ਪਹਿਲਾਂ ਵੀ ਫੋਨ ਕੀਤਾ ਸੀ ਜੀ ਪਹਿਲਾਂ ਵੀ ਨਹੀਂ ਕੋਈ ਰਿਪਲਾਈ ਆਇਆ ਤੁਹਾਡੇ ਵੱਲੋਂ ਜੇ ਪਾਣੀ ਹਾਂਜੀ ਜੇ ਪਾਣੀ ਆ ਵੀ ਰਿਹਾ ਨਾ ਸਾਫ਼ ਨਹੀਂ ਹੈ ਨਹੀਂ ਹੋਰ ਵੀ ਮਤਲਬ ਪਿੰਡ 'ਚ ਹੀ ਹੈ ਪਾਣੀ ਆ ਵੀ ਰਿਹਾ ਅਤੇ ਸਾਫ਼ ਨਹੀਂ ਆ ਰਿਹਾ ਬਹੁਤ ਗੰਦਾ ਪਾਣੀ ਆ ਰਿਹਾ ਉਹ ਕਿਸੇ ਯੂਜ਼ ਲਈ ਵੀ ਯੂਜ਼ ਵਿੱਚ ਵੀ ਨਹੀਂ ਆ ਰਿਹਾ ਨਾ ਪੀਣ ਲਈ ਪੀ ਕੇ ਬਿਮਾਰ ਹੋ ਰਹੇ ਹੋਰ ਕਿਸੇ ਕੰਮ ਲਈ ਵੀ ਵਰਤੋ 'ਚ ਨਹੀਂ ਆ ਰਿਹਾ ਪਾਣੀ ਨਹੀਂ ਮੈਮ ਅਸੀਂ ਕਨਫਰਮ ਕਰਕੇ ਤੁਹਾਨੂੰ ਫੋਨ ਕਰ ਰਹੇ ਹਾਂ ਅਸੀਂ ਸਾਰਾ ਕਨਫਰਮ ਕਰ ਲਿਆ ਪਲੰਬਰ ਤੋਂ ਚੈੱਕ ਕਰਵਾ ਲਿਆ ਸਾਰਾ ਕੁੱਝ ਚੈੱਕ ਕਰਵਾ ਲਿਆ ਪਿੱਛੇ ਤੋਂ ਵੀ ਸਹੀ ਨਹੀਂ ਆ ਰਿਹਾ ਅਸੀਂ ਪਹਿਲਾਂ ਵੀ ਕੰਪਲੇਂਟ ਕੀਤੀ ਸੀ ਤੁਸੀਂ ਕੋਈ ਰਿਪਲਾਈ ਨਹੀਂ ਕੀਤਾ ਹੈ ਤੁਸੀਂ ਕਹਿੰਦੇ ਸੀ ਪਹਿਲਾਂ ਕਿ ਅਸੀਂ ਟੀਮ ਭੇਜਾਂਗੇ ਟੀਮ ਭੇਜਾਂਗੇ ਚੈੱਕ ਕਰਕੇ ਜਾਣਗੇ ਨਹੀਂ ਨਹੀਂ ਐਵੇਂ ਦੀ ਕੋਈ ਸਾਡੀ ਸਮੱਸਿਆ ਅਸੀਂ ਬਹੁਤ ਵਾਰ ਫ਼ੋਨ ਕੀਤਾ ਜੀ ਸਾਡੀ ਸਮੱਸਿਆ ਹਜੇ ਤੱਕ ਹੱਲ ਨਹੀਂ ਹੋਈ ਕਿਰਪਾ ਕਰਕੇ ਸਾਡੀ ਸਮੱਸਿਆ ਹੱਲ ਕਰੋ ਜੀ ਅਸੀਂ ਬਹੁਤ ਬਿਮਾਰ ਹੋ ਰਹੇ ਹਾਂ ਜੀ ਪਾਣੀ ਪੀ ਕੇ ਬਹੁਤ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਜੀ ਸਿਹਤ 'ਤੇ ਜੀ ਪਾਣੀ ਬਿਲਕੁਲ ਸਹੀ ਨਹੀਂ ਆ ਰਿਹਾ ਪਾਣੀ ਨਾਲ਼ ਹੀ ਸਾਰੇ ਕੰਮ ਹੁੰਦੇ ਪਾਣੀ ਬਿਨਾਂ ਹੁਣ ਕਿੱਥੇ ਸਰਦਾ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਮੈਮ ਜ਼ਰੂਰ ਹਾਂਜੀ ਅਸੀਂ ਇੰਤਜ਼ਾਰ ਕਰਾਂਗੇ ਜੀ ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜੀ ਠੀਕ ਹੈ ਜੀ ਮੈਮ ਥੈਂਕਯੂ ਜੀ